ਸਕੂਲਾਂ ਦੇ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਲਈ ਬੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਪਹਿਲੀ ਚੀਜ਼ ਤਾਂ ਅਧਿਆਪਕਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੋਣੀ ਚਾਹੀਦੀ ਹੈ ਕਿ ਅਸੀਂ ਬੱਚਿਆਂ ਨੂੰ ਹਰ ਇੱਕ ਚੀਜ਼ ਦੇ ਹਰ ਇੱਕ ਚੀਜ਼ ਦੀ ਨੌਲੇਜ ਦੇਈਏ ਕਿ ਉੱਠਣਾ ਕਿਵੇਂ ਬਹਿਣਾ ਕਿਵੇਂ ਕਿਸੇ ਨਾਲ ਗੱਲ ਕਿਵੇਂ ਕਰਨੀ ਹੈ ਅਤੇ ਫਿਰ ਉਹਦੇ ਬਾਅਦ ਜਿਹੜਾ ਉਹ ਸਬਜੈਕਟ ਪੜ੍ਹਾ ਰਿਹਾ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ ਫਿਰ ਉਹਦੇ ਬਾਅਦ ਜਿਵੇਂ ਕਿ ਟੀਚਰਸ ਨੂੰ ਸਕੂਲਾਂ ਦੇ ਵਿੱਚ ਟੀਚਰਸ ਨੂੰ ਵਾਈਟ ਬੋਰਡ ਪ੍ਰੋਵਾਈਡ ਕੀਤੇ ਜਾਣ ਪ੍ਰੋਜੈਕਟਰ ਪ੍ਰੋਵਾਈਡ ਕੀਤੇ ਜਾਣ ਟੇਬਲ ਪ੍ਰੋਵਾਈਡ ਕੀਤੇ ਜਾਣ ਕਿਉਂਕਿ ਟੀਚਰਸ ਵੀ ਥੱਕ ਜਾਂਦੇ ਹਨ ਕਦੇ ਕਦਾਰ ਅਤੇ ਫਿਰ ਉਹਦੇ ਬਾਅਦ ਸਕੂਲਾਂ ਦੇ ਵਿੱਚ ਆਪਣਾ ਕਿ ਵੱਡੇ ਵੱਡੇ ਗਰਾਊਂਡ ਹੋਣੇ ਚਾਹੀਦੇ ਆ ਜਿਹਦੇ ਕਰਕੇ ਕਿ ਬੱਚੇ ਖੇਡ ਸਕਣ ਫਿਰ ਉਹਦੇ ਬਾਅਦ ਐ ਆਪਣੀਆਂ ਐਕਸਟਰਾ ਕਲੀਕੂਲਰ ਐਕਟੀਵਿਟੀ ਕਰ ਸਕਣ ਕਿ ਉੱਥੇ ਡਾਂਸ ਕਲਾਸਿਜ ਦਾ ਵੀ ਪ੍ਰ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਫਿਰ ਉਹਦੇ ਬਾਅਦ ਜਿਵੇਂ ਕਿ ਆਪਣਾ ਜਿਵੇਂ ਸਵੀਮਿੰਗ ਪੂਲ ਕਿ ਜਿੱਦਾਂ ਕਿਸੇ ਬੱਚੇ ਨੂੰ ਸਮਿੰਮ ਸਵੀਮਿੰਗ ਕਿਸੇ ਨੂੰ ਸਵੀਮਿੰਗ ਅੱਛੀ ਲੱਗਦੀ ਹੈ ਅਤੇ ਬੱਚਾ ਸਵੀਮਿੰਗ ਕਰ ਸਕੇ ਜਾਂ ਤਾਂ ਫਿਰ ਜੇ ਕਿਸੇ ਨੂੰ ਕ੍ਰਿਕਟ ਪਸੰਦ ਹੈ ਉਹ ਕ੍ਰਿਕਟ ਕਰ ਸਕਦਾ ਹੈ